ਵੈਸੇ ਤਾਂ ਪੰਜਾਬ ਵਿੱਚ ਬਹੁਤ ਸਾਰੀਆਂ ਖਰੀਦਦਾਰੀ ਦੀਆਂ ਥਾਵਾਂ ਹਨ ਜਿਵੇਂ ਕਿ ਲੁਧਿਆਣਾ ਲੁਧਿਆਣੇ ਨੂੰ ਕੱਪੜੇ ਲਈ ਸਭ ਤੋਂ ਮਸ਼ਹੂਰ ਗਿਣਿਆ ਜਾਂਦਾ ਹੈ ਕੱਪੜੇ ਖਰੀਦਦਾਰੀ ਲਈ ਮਸ਼ਹੂਰ ਗਿਣਿਆ ਜਾਂਦਾ ਹੈ ਅੰਮ੍ਰਿਤਸਰ ਨੂੰ ਧਾਰਮਿਕ ਸਮਾਨ ਨਾਲ਼ ਰਿਲੇਟਡ ਖਰੀਦਦਾਰੀ ਲਈ ਗਿਣਿਆ ਜਾਂਦਾ ਹੈ ਅਤੇ ਜਲੰਧਰ ਨੂੰ ਸਪੋਰਟਸ ਸਮਾਨ ਲਈ ਗਿਣਿਆ ਜਾਂਦਾ ਹੈ ਜਲੰਧਰ ਨੂੰ ਫੁਲਕਾਰੀ ਪੁਰਸਕਾਰ ਵਿੱਚ ਜੀ ਆਈ ਅਵਾਰਡ ਵੀ ਮਿਲਿਆ ਹੈ